ਯੋਗਾ ਸਰੀਰ ਲਈ ਬਹੁਤ ਜ਼ਰੂਰੀ ਹੈ ਜੋ ਤੁਸੀਂ ਸਭ ਜਾਣਦੇ ਹੋ ਯੋਗਾ ਕੋਈ ਵੀ ਵਿਅਕਤੀ ਕਿਸੇ ਵੀ ਉਮਰ 'ਚ ਕਰ ਸਕਦਾ ਹੈ ਇਸਨੂੰ ਬੱਚੇ ਵੀ ਕਰਦੇ ਹਨ ਇਸਨੂੰ ਬਜ਼ੁਰਗ ਔਰਤਾਂ ਅਤੇ ਦਾ ਨੌਜਵਾਨ ਵੀ ਕਰਦੇ ਆ ਜਿਸ ਨਾਲ ਉਹ ਆਪਣਾ ਸਰੀਰ ਜਿਹੜਾ ਹੈ ਮਜ਼ਬੂਤ ਬਣਾਉਂਦੇ ਹਨ ਵੱਖ ਵੱਖ ਉਮਰਾਂ ਦੁਆਰਾ ਕੀਤੀ ਗਈ ਯੋਗਾ ਬੱਚਿਆਂ ਦੁਆਰਾ ਕੀਤੀ ਗਈ ਸਰੀਰ ਦੀ ਮਜ਼ਬੂਤੀ ਹੱਡੀਆਂ ਮਜੂਦ ਕਰਨਾ ਉਹਨਾਂ ਦੀ ਮਾਨਸਿਕ ਵਿਕਾਸ ਜਿਹੜਾ ਹੈ ਤੇਜ਼ ਹੁੰਦਾ ਹੈ ਬਜ਼ੁਰਗ ਵਿਅਕਤੀ ਅਗਰ ਯੋਗਾ ਕਰਦਾ ਹੈ ਤੋਂ ਆਪਣੇ ਜੇ ਕੋਈ ਹੋਈ ਸਰੀਰ ਦੀ ਬਿਮਾਰੀ ਜਾਂ ਆਦਤ ਤੋਂ ਆਪਣੇ ਸਰੀਰ ਨੂੰ ਹੋਰ ਮਜ਼ਬੂਤ ਕਰਦਾ ਹੈ ਜਿਸ ਨਾਲ ਉਹ ਇੱਕ ਵਧੀਆ ਜ਼ਿੰਦਗੀ ਅਤੇ ਲੰਬੀ ਜ਼ਿੰਦਗੀ ਜੀਣ ਦਾ ਵੀ ਕਾਬਿਲ ਹੋ ਜਾਂਦਾ ਹੈ ਯੋਗ ਤਾਂ ਯੋਗ ਦੁਆਰਾ ਸਹੀ ਯੋਗ ਦੀ ਸਹੀ ਜਾਣਕਾਰੀ ਹੋਣਾ ਸਭ ਤੋਂ ਪਹਿਲਾਂ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਯੋਗ ਜਿਹੜਾ ਹੈ ਸਾਡੇ ਸਰੀਰ ਦੇ ਮਾਨਸਿਕ ਤੌਰ 'ਤੇ ਜ਼ਿਆਦਾ ਪ੍ਰਭਾਵ ਪਾਉਂਦਾ ਹੈ ਅਤੇ ਅੰਦਰੂਨੀ ਨੂੰ ਜ਼ਿਆਦਾ ਹੀ ਮਜ਼ਬੂਤ ਕਰਦਾ ਹੈ ਜਿਸ ਨਾਲ ਸਾਡੀਆਂ ਨਸਾਂ ਸਾਡੇ ਸਰੀਰ ਦੇ ਵੱਖ ਵੱਖ ਅੰਗ ਜਿਵੇਂ ਫੇਫੜੇ ਦਿਲ ਗੁਰਦੇ ਮੈਦਾ ਇਹ ਸਭ ਮਜ਼ਬੂਤ ਕਰਨ ਲਈ ਯੋਗ ਬਹੁਤ ਹੀ ਵੱਡਾ ਯੋਗਦਾਨ ਦਿੰਦਾ ਹੈ ਇਸ ਲਈ ਇਸਦੀ ਸਹੀ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਜਿਸ ਨਾਲ ਅਸੀਂ ਆਪਣੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਬਿਹਤਰ ਬਣਾ ਸਕੀਏ ਪਿਛ ਪਿਛੋਕੜ ਵਾਲੇ ਲੋਕ ਜਿਵੇਂ ਬੈਕਵਰਡ ਏਰੀਆ ਜਿਵੇਂ ਪਿੰਡਾਂ ਦੇ ਲੋਕ ਆ ਇਹਨਾਂ ਨੂੰ ਯੋਗ ਬਾਰੇ ਬਹੁਤੀ ਜਾਣਕਾਰੀ ਨਾ ਹੋਣ ਕਾਰਨ ਫਿਰ ਵੀ ਇਹਨਾਂ ਦੇ ਸਰੀਰ ਮਜ਼ਬੂਤ ਕਿਉਂ ਹੁੰਦੇ ਕਿਉਂਕਿ ਇਹ ਖੇਤੀਬਾੜੀ ਦੇ ਨਾਲ ਸਰੀਰਕ ਤੌਰ 'ਤੇ ਕੰਮ ਕਰਦੇ ਹਨ ਜਿਸ ਨਾਲ ਇਹਨਾਂ ਦੇ ਸਰੀਰ ਜਿਹੜਾ ਹੈ ਉਹ ਆਪਣੇ ਉਹ ਆਪਣੇ ਆਪ ਹੀ ਇੱਕ ਵੱਖ ਢੰਗ ਨਾਲ ਮਜ਼ਬੂਤ ਹੋ ਜਾਂਦਾ ਹੈ ਅਤੇ ਪਿੰਡਾਂ ਵਾਲੇ ਲੋਕ ਜ਼ਿਆਦਾਤਰ ਸੈਰ ਹੀ ਕਰਨਾ ਪਸੰਦ ਕਰਦੇ ਹਨ ਅਤੇ ਉਸ ਤੋਂ ਬਾਅਦ ਖੇਤਾਂ ਦੇ ਵਿੱਚ ਆਪਣੇ ਹੱਥਾਂ ਦੁਆਰਾ ਆਪਣੇ ਮਤਲਬ ਸਰੀਰਕ ਪੱਖੋਂ ਸਰੀਰਕ ਜਿਹੜੀ ਹੈ ਕਸਰਤ ਕਰਦੇ ਹਨ ਜਿਵੇਂ ਖੇਤਾਂ ਵਿੱਚ ਕਹੀ ਚਲਾਉਣਾ ਘਾਹ ਪਸ਼ੂਆਂ ਵਾਸਤੇ ਘਾਹ ਜਿਸ ਨਾਲ ਉਹਨਾਂ ਦਾ ਸਰੀਰ ਜਿਹੜਾ ਹੈ ਉਸ ਢੰਗ ਨਾਲ ਹੀ ਵਿਕਸਿਤ ਹੁੰਦਾ ਹੈ ਅਤੇ ਯੋਗਤਾ ਵਾਲੇ ਯੋਗ ਕਰਦੇ ਆ ਤਾਂ ਉਹ ਕਮਰੇ ਵਿੱਚ ਬੈਠੇ ਬੈਠ ਕੇ ਕਰ ਸਕਦੇ ਹਨ ਅਤੇ ਜਿਵੇਂ ਸ਼ਹਿਰਾਂ ਦੇ ਵਿੱਚ ਮੈਦਾਨ ਵਗੈਰਾ ਨਹੀਂ ਹੁੰਦੇ ਹਨ ਜਿਸ ਨਾਲ ਜਿਹੜਾ ਕਿ ਕੋਈ ਜਾਣਕਾਰ ਵਿਅਕਤੀ ਇਸ ਨੂੰ ਘਰ ਬੈਠੇ ਹੀ ਕਰ ਸਕਦਾ ਹੈ ਅਤੇ ਆਪਣਾ ਇੱਕ ਸ਼ਾਂਤ ਦਿਮਾਗ ਜਿਹੜਾ ਉਹ ਪੈਦਾ ਕਰਦਾ ਹੈ ਅਤੇ ਯੋਗ ਕੋਈ ਵਿਅਕਤੀ ਜਿਹੜੇ ਜਿਸ ਉਮਰ 'ਚ ਕਰਦਾ ਹੈ ਉਹ ਆਪਣੀ ਉਮਰ ਦੇ ਅਨੁਸਾਰ ਉਸਦਾ ਇੱਕ ਸਹੀ ਲਾਭ ਉਹਨੂੰ ਯੋਗ ਦੁਆਰਾ ਦਿੱਤਾ ਜਾਂਦਾ ਹੈ ਅਤੇ ਯੋਗ ਲਈ ਸਭ ਤੋਂ ਵਧੀਆ ਸਮਾਂ ਸਵੇਰ ਦਾ ਜੋ ਤੁਸੀਂ ਸਭ ਜਾਣਦੇ ਹੋ ਅਤੇ ਇਸ ਨਾਲ ਸਾਨੂੰ ਕਈ ਸਾਰੇ ਲਾਭ ਜਿਹੜੇ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਵੱਖ ਵੱਖ ਲਾਭ ਅਤੇ ਨਵੀਂ ਨਵੀਂ ਸਾਡੀ ਸੋਚ ਨੂੰ ਤਬਦੀਲੀ ਆਉਂਦੀ ਹੈ ਅਤੇ ਸਾਡੀ ਜਿਹੜੀ ਹੈ ਸਰੀਰਕ ਜਿਹੜੀ ਪਰਸਨੈਲਿਟੀ ਹੈ ਉਹ ਇੱਕ ਵੱਖਰਾ ਹੀ ਅੰਦਾਜ਼ ਲੈਂਦੀ ਹੈ ਅਤੇ ਜਿਸ ਨਾਲ ਸਾਡੀ ਸਮਾਜ ਵਿੱਚ ਇੱਕ ਅਲੱਗ ਪਹਿਚਾਣ ਹੋ ਜਾਂਦੀ ਹਨ